ਬੁਣਾਈ ਦੇ ਦੌਰਾਨ ਮੈਨੂੰ ਸਭ ਤੋਂ ਜਿੱਦਾਂ ਸਵੈਟਰ ਟੋਪੀਆਂ ਦੇ ਵਿੱਚੋਂ ਜਾਂ ਹੋਰ ਕਿਸਮ ਦੀ ਬੁਣਾਈ ਕਰਨ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਰੁਚੀ ਸਵੈਟਰ ਬਣਾਉਣ 'ਚ ਲੱਗਦੀ ਹੈ ਕਿਉਂਕਿ ਸਵੈਟਰ ਬਣਾਉਣਾ ਮੇਰਾ ਸ਼ੌਕ ਹੈ ਕਿਉਂਕਿ ਇਹਦੇ ਵਿੱਚ ਨਾ ਕਈ ਤਰ੍ਹਾਂ ਦੇ ਡਿਜ਼ਾਈਨ ਪਾਏ ਜਾਂਦੇ ਆ ਜਿੱਦਾਂ ਫਲਾਵਰ ਵਾਲੇ ਡਿਜਾਈਨ ਲੇਅਰ ਵਾਲੇ ਡਿਜਾਈਨ ਅਤੇ ਮੇਰਾ ਵੀ ਇਹ ਹੁੰਦਾ ਮੋਟਿਵ ਕਿ ਮੈਂ ਸਭ ਤੋਂ ਵੱਧ ਡਿਜਾਈਨ ਜਿੱਦਾਂ ਅਲੱਗ ਅਲੱਗ ਤਰ੍ਹਾਂ ਦੇ ਡਿਜ਼ਾਇਨ ਪਾਵਾਂ ਕਈ ਵੇਲੇ ਮੈਂ ਉਹ ਕਰ ਲੈਂਦੀ ਹੀ ਸੀਗੀ ਕਿ ਸਵੈਟਰ ਦਾ ਹੇਠੋਂ ਡਿਜ਼ਾਇਨ ਸ਼ੁਰੂ ਕਰ ਲੈਣਾ ਕਿਸੇ ਵੇਲੇ ਦਾ ਨੀਚੇ ਜਿਹੜੇ ਬੋਰਡਰ ਹੁੰਦੇ ਸੀ ਉਹਦੇ 'ਚ ਹੀ ਮੈਂ ਕਈ ਤਰ੍ਹਾਂ ਦੇ ਮੇਰਾ ਸ਼ੌਕ ਹੈ ਕਿ ਉਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਬੋਰਡਰ ਬਣਾ ਕੇ ਫਿਰ ਮੈਂ ਸਵੈਟਰ ਸ਼ੁਰੂ ਕਰਾਂ ਅਤੇ ਇਹਦੇ ਵਿੱਚ ਮੈਂ ਗੋਲ ਗਲੇ ਵਾਲੇ ਵੀ ਸਵੈਟਰ ਬਣਾਏ ਆ ਵੀ ਸ਼ੇਪ ਵਾਲੇ ਵੀ ਬਣਾਏ ਆ ਕੋਲਰ ਵਾਲੇ ਵੀ ਬਣਾਏ ਆ ਅਤੇ ਜੈਕਟ ਓਪਨ ਵੀ ਕਈ ਵੇਲੇ ਮੈਂ ਜੈਕਟ ਬਣਾ ਲੈਂਦੀ ਰਹੀ ਹਾਂ ਮੈਨੂੰ ਕਾਫੀ ਕਈਆਂ ਕਈਆਂ 'ਚ ਮੈਂ ਪੋਕਟ ਲਾ ਦੇਣੀ ਕਈਆਂ 'ਚ ਮੈਂ ਮਤਲਬ ਬਟਨਾਂ ਵਾਲੇ ਬਣਾ ਲੈਣੇ ਮੈਨੂੰ ਕਿਉਂਕਿ ਸਵੈਟਰ ਜ਼ਿਆਦਾ ਅੱਛਾ ਲੱਗਦੇ ਕੋਟੀਆਂ ਬਣਾਉਣਾ ਸਵੈਟਰ ਬਣਾਉਣਾ ਲੇਡੀਜ ਸਵੈਟਰ ਬਣਾਉਣੇ ਅਤੇ ਜੈਂਟਸ ਬੱਚਿਆਂ ਦੇ ਸਵੈਟਰ ਬਣਾਉਣੇ ਕਈਆਂ ਦੇ ਬਿੱਬ ਲਗਾ ਦੇਣਾ ਇਹ ਮੈਨੂੰ ਜ਼ਿਆਦਾ ਲੱਗਦਾ ਇਹਨਾਂ ਸਾਰਿਆਂ ਦੇ ਵਿੱਚੋਂ ਮੇਰਾ ਸ਼ੌਕ ਜ਼ਿਆਦਾ ਸਵੈਟਰ ਬਣਾਉਣ ਦਾ ਹੀ ਹੈ ਕਿਉਂਕਿ ਮੈਨੂੰ ਲੱਗਦਾ ਸੀਗਾ ਕਿ ਇਹ ਇਹਨੂੰ ਜ਼ਿਆਦਾ ਮੈਂ ਆਪਣੇ ਸਹੀ ਤਰੀਕੇ ਨਾਲ ਪੇਸ਼ ਕਰ ਸਕਦੀ ਹਾਂ ਮੈਂ ਕਈ ਤਰ੍ਹਾਂ ਦੇ ਸਵੈਟਰ ਬਣਾਏ ਆ ਅਤੇ ਸਵੈਟਰ ਹੀ ਮੇਰਾ ਜ਼ਿਆਦਾ ਰੁਚੀ ਰੱਖਦੀ ਹਾਂ